ਸ਼ੌਂਕ ਵਜੋਂ ਫੋਟੋਗ੍ਰਾਫੀ ਜਾਰੀ ਰੱਖਣ ਲਈ ਮੇਰੀ ਪ੍ਰੇਰਨਾ ਆਪਣੇ ਆਪ ਨੂੰ ਪਿਆਰ ਅਤੇ ਕੁਦਰਤ ਨਾਲ ਪਿਆਰ ਹੈ ਆਪਣੇ ਆਪ ਨਾਲ ਪਿਆਰ ਵਿੱਚ ਮੈਂ ਆਪਣੀਆਂ ਫੋਟੋਆਂ ਖਿੱਚਣ ਅਤੇ ਖਿਚਵਾਉਣਾ ਪਸੰਦ ਕਰਦਾ ਹਾਂ ਫੋਟੋਆਂ ਖਿੱਚਣ ਤੋਂ ਬਾਅਦ ਜਦੋਂ ਮੈਨੂੰ ਲਾਈਕ ਕਮੈਂਟ ਮਿਲਦੇ ਹਨ ਤਾਂ ਮੇਰੇ ਅੰਦਰ ਇੱਕ ਅਜੀਬ ਜਿਹਾ ਸੈਲਫ ਕੋਨਫੀਡੈਂਸ ਬਣਦਾ ਹੈ ਜੋ ਮੈਨੂੰ ਜ਼ਿੰਦਗੀ ਵਿੱਚ ਅਗਾਂਹ ਵਧੂ ਸੋਚਣ ਰੱਖਣ ਲਈ ਪ੍ਰੇਰਦਾ ਹੈ ਕੁਦਰਤੀ ਨਜ਼ਾਰਿਆਂ ਦੀ ਫੋਟੋਆਂ ਖਿੱਚਣਾ ਆਪਣੇ ਆਪ ਨੂੰ ਵਿੱਚ ਇੱਕ ਵੱਖਰਾ ਅਨੁਭਵ ਹੈ ਸਵੇਰ ਦੇ ਸਮੇਂ ਫੁੱਲ ਦਾ ਖਿੜਨਾ ਜ਼ਿੰਦਗੀ ਨੂੰ ਹਰ ਸਮੇਂ ਖਿੜੇ ਮੱਥੇ ਲੈਣ ਦਾ ਅਨੁਭਵ ਹੈ ਪੰਛੀਆਂ ਦਾ ਚਹਿਚਹਾਣਾ ਇੱਕ ਡਰ ਬਣ ਕੇ ਉੱਡਣਾ ਤੋਂ ਭਾਵ ਹਰ ਮੁਸੀਬਤ ਦਾ ਸਾਹਮਣਾ ਕਰਨਾ ਸੂਰਜ ਦਾ ਨਿਕਲਣਾ ਅਤੇ ਡੁੱਬਣਾ ਹਰ ਦਿਨ ਦੀ ਸ਼ੁਰੂਆਤ ਨੂੰ ਪ੍ਰੇਰਦਾ ਹੈ ਫੋਟੋਗ੍ਰਾਫਰੀ ਅਸਲ ਵਿੱਚ ਉਸ ਸਮੇਂ ਜਾਂ ਪਲ ਨੂੰ ਬੰਨ੍ਹ ਲੈਂਦਾ ਹੈ ਜਿਸ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ ਚਾਹੁੰਦੇ ਹੋ